ਸਾਡਾ ਹੈਲਥ ਸਿਸਟਮ ਠੀਕ ਹੈ ਪਰ ਸੁਧਾਰ ਕਰਨ ਦੀ ਲੋੜ ਹੈ ਸਿਸਟਮ ਵਿੱਚ ਸਾਨੂੰ ਕਾਫੀ ਸੁਧਾਰ ਕਰਨ ਦੀ ਜ਼ਰੂਰਤ ਹੈ ਜਿਵੇਂ ਕਿ ਮੈਡੀਸਿਨਸ ਭਾਵ ਦਵਾਈਆਂ ਦੀ ਕੁਆਲਿਟੀ ਅਤੇ ਕੁਆਂਟਿਟੀ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਹੈ ਕਈ ਦਵਾਈਆਂ ਕੁਆਲਿਟੀ ਦੀਆਂ ਨਹੀਂ ਹੁੰਦੀਆਂ ਅਤੇ ਡੁਪਲੀਕੇਟ ਹੁੰਦੀਆਂ ਹਨ ਜਿਨ੍ਹਾਂ ਦੇ ਕਾਰਨ ਕਈ ਮਰੀਜ਼ ਜ਼ਿਆਦਾ ਬਿਮਾਰ ਹੋ ਜਾਂਦੇ ਹਨ ਕਈ ਦਵਾਈਆਂ ਮੈਡੀਸਿਨ ਸਾਨੂੰ ਬਾਹਰ ਤੋਂ ਮੰਗਵਾਉਣੀਆਂ ਪੈਂਦੀਆਂ ਹਨ ਕਈ ਹਸਪਤਾਲਾਂ ਵਿੱਚ ਦਵਾਈਆਂ ਦੀ ਬਹੁਤ ਜ਼ਿਆਦਾ ਸ਼ੋਰਟੇਜ ਕੁਆਂਟਿਟੀ ਬਹੁਤ ਘੱਟ ਹੁੰਦੀ ਹੈ ਕੁਆਂਟਿਟੀ ਦੇ ਘੱਟ ਹੋਣ ਦੇ ਨਾਲ ਦਵਾਈਆਂ ਦੀ ਕੁਆਲਿਟੀ ਵੀ ਠੀਕ ਨਹੀਂ ਹੁੰਦੀ ਅਤੇ ਕਈ ਹਸਪਤਾਲਾਂ ਵਿੱਚ ਡਾਕਟਰ ਦੀ ਸ਼ੋਰਟਏਜ਼ ਵੀ ਬਹੁਤ ਹੁੰਦੀ ਹੈ ਵੱਡੇ ਵੱਡੇ ਹਸਪਤਾਲ ਹੋਸਪਿਟਲਾਂ ਵਿੱਚ ਡਾਕਟਰ ਬਹੁਤ ਘੱਟ ਮਾਤਰਾ ਵਿੱਚ ਹੁੰਦੇ ਹਨ ਅਤੇ ਸਾਨੂੰ ਬਾਹਰ ਤੋਂ ਡਾਕਟਰ ਮੰਗਵਾਉਣੇ ਪੈਂਦੇ ਹਨ ਜਿਨ੍ਹਾਂ ਦਾ ਜਿਨ੍ਹਾਂ ਦੇ ਕਾਰਨ ਦਵਾਈਆਂ ਪੇਸ਼ੈਸ ਬਹੁਤ